ਪਾਲਤੂ ਜਾਨਵਰਾਂ ਦੇ ਵਿੱਚੋਂ ਮੇਰੇ ਕੋਲ ਕੁੱਤੇ ਹਨ ਉਹਨਾਂ ਦੀ ਇੱਕ ਵੱਡੀ ਖਾਸੀਅਤ ਹੈ ਵੀ ਜਿਹੜਾ ਕੁੱਤਾ ਇਹ ਵੱਡਾ ਹੀ ਵਫਾਦਾਰ ਜਾਨਵਰ ਹੈ ਬਸ ਇਹ ਇਹਦੀ ਸਭ ਤੋਂ ਵੱਡੀ ਮੈਨੂੰ ਜਿਹੜੇ ਮੇਰੇ ਮਨ ਨੂੰ ਲੱਗੀ ਹੈ ਕੁੱਤੇ ਤੋਂ ਕੋਈ ਦੁਨੀਆਂ ਦੇ ਅੰਦਰ ਕੋਈ ਵਫਾਦਾਰ ਨਹੀਂ ਹੈ